ਮੈਂ ਅੱਜ ਤੁਹਾਡੇ ਨਾਲ ਆਪਣੇ ਪਰਿਵਾਰਕ ਪਕਵਾਨਾਂ ਬਾਰੇ ਦੱਸ ਰਹੀ ਹਾਂ ਅਸੀਂ ਜਿਵੇਂ ਕਿ ਇਸ ਠੰਡ ਦੇ ਮੌਸਮ ਦੇ ਵਿੱਚ ਸਾਗ ਮੱਕੀ ਦੀ ਰੋਟੀ ਘਰ ਦੇ ਵਿੱਚ ਖਾਣਾ ਬਹੁਤ ਹੀ ਪਸੰਦ ਕਰਦੇ ਹਾਂ ਅਤੇ ਜਿਵੇਂ ਕਿ ਆਪਾਂ ਕਰਵ ਘਰ ਦੇ ਵਿੱਚ ਪ੍ਰਸ਼ਾਦ ਵੀ ਬਣਾਉਂਦੇ ਹਾਂ ਪ੍ਰਸ਼ਾਦ ਵਿੱਚ ਜਿਵੇਂ ਕਿ ਆਪਾਂ ਰਵਾ ਜਾਂ ਫਿਰ ਆਟਾ ਵੀ ਚੂਜ਼ ਕਰ ਸਕਦੇ ਹਾਂ ਇਸ ਤੋਂ ਇਲਾਵਾ ਵਿੱਚ ਕਾਜੂ ਬਦਾਮ ਅਤੇ ਗਰਮ ਪਾਣੀ ਪਾ ਕੇ ਹੀ ਆਪਾਂ ਇਸ ਨੂੰ ਇਹ ਪ੍ਰਸ਼ਾਦ ਬਣਾ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਜਿਵੇਂ ਸਰਦੀਆਂ ਵਿੱਚ ਆਮ ਤੌਰ 'ਤੇ ਆਪਾਂ ਠੰਡ ਤੋਂ ਬਚਣ ਦੇ ਲਈ ਹੀ ਆਪਾਂ ਪੰਜੀਰੀ ਵਗੈਰਾ ਬਣਾਉਂਦੇ ਹਾਂ ਜਿਵੇਂ ਕਿ ਉਸ ਦੇ ਵਿੱਚ ਚਨੇ ਪਾਏ ਜਾਂਦੇ ਹਨ ਚਨਿਆਂ ਤੋਂ ਇਲਾਵਾ ਗੁੰਦਾ ਵੀ ਚਾਰ ਗੁੰਦਾ ਵੀ ਪਾਈਆਂ ਜਾਂਦੀਆਂ ਹਨ ਕਾਜੂ ਬਦਾਮ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਵਿੱਚ ਮਿਲਾਈਆਂ ਜਾਂਦੀਆਂ ਹਨ ਜਿਵੇਂ ਸੌਂਫ ਅਜਵਾਇਣ ਅਜਵਾਇਣ ਖਜੂਰ ਆਦਿ ਮਿਲਾਏ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਆਪਾਂ ਘਿਉ ਪਹਿਲਾਂ ਘਿਉ ਗਰਮ ਕਰਕੇ ਉਸ ਦੇ ਵਿੱਚ ਸਾਰਾ ਕੁਝ ਹੀ ਮਿਲਾ ਦੇਣਾ ਅਤੇ ਮਿਲਾਉਣ ਤੋਂ ਬਾਅਦ ਉਸ ਨੂੰ ਠੰਡਾ ਕਰਕੇ ਹੀ ਆਪਾਂ ਇਸ ਨੂੰ ਖਾ ਸਕਦੇ ਹਾਂ